ਪੰਜਾਬ ਵਿੱਚ ਕਈ ਪ੍ਰਮੁੱਖ ਬੈਂਕਿੰਗ ਅਤੇ ਬੀਮਾ ਘਟਨਾਵਾਂ ਹਨ ਜੋ ਕਿ ਕਈ ਤਰ੍ਹਾਂ ਦੇ ਪੇਸ਼ੇਵਰਾਂ ਨੂੰ ਇਕੱਠੇ ਕਰਦੀਆਂ ਹਨ ਆਈਡੀਬੀਆਈ ਇੱਕ ਤਾਂ ਆਈਡੀਐੱਫ ਸੀ ਬੈਂਕਿੰਗ ਹੈਗੀ ਹੈ ਜਿਹੜੀ ਕਿ ਕਈ ਤਰ੍ਹਾਂ ਦੀਆਂ ਕੋਂਨਫਰੰਸ ਰੱਖ ਕੇ ਅਤੇ ਕਈ ਤਰ੍ਹਾਂ ਦੇ ਉਦਯੋਗਿਕ ਅਤੇ ਅਕਾਦਮਿਕ ਲੋਕਾਂ ਨੂੰ ਇਕੱਠੇ ਕਰਦੀਆਂ ਹਨ ਪੰਜਾਬ ਵਿੱਚ ਇੱਕ ਐਲਆਈਸੀ ਇੱਦਾਂ ਦਾ ਇਕ ਕੇਂਦਰ ਹੈ ਜਿਹੜਾ ਕਿ ਬਹੁਤ ਸਾਰੇ ਦੇਸ਼ੀ ਅਤੇ ਵਿਦੇਸ਼ੀ ਲੋਕਾਂ ਨੂੰ ਇਕੱਠੇ ਕਰਦਾ ਹੈ ਅਤੇ ਉਹਨਾਂ ਨੂੰ ਅੱਗੇ ਵਧਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਦੱਸਦਾ ਹੈ ਇਹ ਬੈਂਕ ਫਿਨਟੈਕ ਸਮਿਟ ਅਤੇ ਹੋਰ ਤਰ੍ਹਾਂ ਦੀਆਂ ਕਾਨਫਰਸ ਰੱਖਦਾ ਹੈ ਅਤੇ ਇਸ ਵਿੱਚ ਕਈ ਕਿਸੇ ਤਰ੍ਹਾਂ ਦੇ ਦੇਸ਼ ਵਿੱਚ ਦੇਸ਼ ਵਿੱਚ ਜਿਸ ਤਰ੍ਹਾਂ ਦੇ ਚੱਲ ਰਹੇ ਵੱਖਰੇ ਵੱਖਰੇ ਤਰੀਕੇ ਜਿਸ ਵਿੱਚ ਲੋਕ ਪੈਸਾ ਲਗਾ ਸਕਦੇ ਹਨ ਅਤੇ ਪੈਸਾ ਕਮਾ ਸਕਦੇ ਹਨ ਦੱਸੇ ਜਾ ਰਹੇ ਅੱਜ ਕੱਲ੍ਹ ਪੰਜਾਬ ਦੇ ਨਾਲ ਨਾਲ ਸਾਡੇ ਦੇਸ਼ ਦੇ ਨਾਲ ਨਾਲ ਪੰਜਾਬ ਵੀ ਬਹੁਤ ਤਰੱਕੀ ਕਰ ਰਿਹਾ ਹੈ ਬੈਂਕਿੰਗ ਹੁਣ ਇਕੱਲੇ ਪੰਜਾਬ ਖੇਤਰ ਤੱਕ ਨਹੀਂ ਇਹ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਤੱਕ ਪਹੁੰਚ ਚੁੱਕੀ ਹੈ ਕਈ ਵਿਦੇਸ਼ਾਂ ਵਿੱਚ ਵੀ ਇਸਦਾ ਉਪਯੋਗ ਹੋ ਰਿਹਾ ਹੈ ਧੰਨਵਾਦ